ਗਾਉਣਾ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਆ ਅਤੇ ਗਾਇਆ ਜਾਵੇ ਪਰ ਗਾਉਣ ਸਮੇਂ ਧਿਆਨ ਰੱਖਣਾ ਸਾਨੂੰ ਇਹ ਵੀ ਕਿ ਵੱਧ ਤੋਂ ਵੱਧ ਰਿਆਜ਼ ਕਰਿਆ ਜਾਵੇ ਵੱਧ ਤੋਂ ਵੱਧ ਅਸੀਂ ਮਿਹਨਤ ਕਰੀਏ ਅਤੇ ਗਾਉਣਾ ਸ਼ੁੱਧ ਗਾਉਣਾ ਵਧੀਆ ਕਿਸੇ ਚੰਗੇ ਗੁਰੂ ਤੋਂ ਸਿੱਖਿਆ ਲਵੇ ਵਧੀਆ ਤਾਂ ਜਿਹੜਾ ਉਹਨੂੰ ਦੱਸੇ ਅਤੇ ਉਹਦੇ ਫਿਰ ਦਿੱਤੇ ਹੋਏ ਗੁਣਾਂ 'ਤੇ ਚੱਲੇ ਚੰਗੇ ਗੁਰੂ ਨੂੰ ਧਾਰਨ ਕਰੇ ਚੰਗੇ ਉਸਤਾਦ ਦੇ ਜਿਹੜੇ ਝੰਡੇ ਚੇਲੇ ਚੰਗੇ ਚੇਲੇ ਹੁੰਦੇ ਆ ਚੰਗੇ ਹੁੰਦੇ ਆ ਉਹ ਫਿਰ ਗਾਉਂਦੇ ਵੀ ਵਧੀਆ ਇਸ ਕਰਕੇ ਤਾਂ ਸਾਨੂੰ ਗਾਉਣਾ ਵੀ ਜ਼ਰੂਰੀ ਹੈ ਗਾਓ ਪਰ ਉਹ 'ਚ ਸੁਧਾਰ ਵੀ ਜ਼ਰੂਰੀ ਨੇ ਅਤੇ ਭਾਵ ਚੰਗੀ ਸਿੱਖਿਆ ਲਓ ਵਧੀਆ ਚੰਗੀ ਤਰ੍ਹਾਂ ਮਿਹਨਤ ਕਰੋ ਇਹ ਗਾਉਣ ਦਾ ਉਹ ਕਰੋ ਧੰਨਵਾਦ